ਸਤਾਰ੍ਹਾਂ ਜੂਨ ਉੱਨੀ ਸੌ ਚੁਰਾਸੀ ਛੱਬੀ ਦਸ ਉੱਨੀ ਸੌ ਸਤਾਸੀ ਚੌਦ੍ਹਾਂ ਅਪ੍ਰੈਲ ਦੋ ਹਜ਼ਾਰ ਦਸ ਵੀਹ ਫਰਵਰੀ ਦੋ ਹਜ਼ਾਰ ਗਿਆਰ੍ਹਾਂ ਉਣੱਤੀ ਮਈ ਦੋ ਹਜ਼ਾਰ ਬਾਰ੍ਹਾਂ